ਮੇਰੀ ਆਪਦੀ ਭੈਣ ਮੇਰੇ ਮਾਸੀਆਂ ਮਾਮਿਆਂ ਦੇ ਮੁੰਡੇ ਮੈਂ ਆਪ ਮੇਰੇ ਫਾਦਰ ਮਦਰ ਸਾਰਿਆਂ ਕੋਲ ਹੀ ਕਾਲਜ ਦੀ ਡਿਗਰੀ ਹੈ ਕਿਉਂਕਿ ਅੱਜ ਕੱਲ੍ਹ ਦਾ ਸਮਾਂ ਇਹੋ ਜਿਹਾ ਹੈ ਕਿ ਪੜ੍ਹਾਈ ਤੋਂ ਬਿਨਾਂ ਬੰਦੇ ਦੀ ਕੋਈ ਔਕਾਤ ਨਹੀਂ ਪੜ੍ਹਾਈ ਕਰਨਾ ਅੱਜ ਕੱਲ੍ਹ ਬਹੁਤ ਹੀ ਜ਼ਰੂਰੀ ਹੈ ਤਾਂ ਬਹੁਤ ਸਾਰੇ ਲੋਕ ਅੱਜ ਕੱਲ੍ਹ ਪੜ੍ਹਾਈ ਨੂੰ ਮਹੱਤਵ ਦਿੰਦੇ ਹਨ ਅਤੇ ਕਾਲਜ ਦੀ ਡਿਗਰੀ ਲੈਂਦੇ ਹਨ ਇਹ ਪੁਰਾਣਾ ਸਮਾਂ ਨਹੀਂ ਹੈ ਕਿ ਅੱਠਵੀਂ ਦਸਵੀਂ ਕਰਕੇ ਗੁਜ਼ਾਰਾ ਹੋ ਜਾਂਦਾ ਸੀ ਮੇਰੀ ਆਪਦੀ ਭੈਣ ਨੇ ਪਹਿਲਾਂ ਤਾਂ ਬੀ ਏ ਕੀਤੀ ਫਿਰ ਉਹਨੇ ਇੱਕ ਹੋਰ ਡਿਪਲੋਮਾ ਕੀਤਾ ਫਿਰ ਉਹਨੇ ਮਾਸਟਰਸ ਡਿਗਰੀ ਕੀਤੀ ਜਿਹੜੀ ਕਿ ਅੱਜ ਉਸ ਨੂੰ ਬਹੁਤ ਕੰਮ ਆਉਂਦੀ ਹੈ ਉਹਦੇ ਕੋਲ ਡਿਪਲੋਮਾ ਡਿਗਰੀ ਹੋਣ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਹੁਨਰ ਹਨ ਅਤੇ ਉਹ ਹੁਨਰ ਉਸ ਨੂੰ ਕਾਮਯਾਬੀ ਦੀ ਸੀੜੀ ਚੜਨ ਦੇ ਕੰਮ ਹੀ ਆ ਰਹੇ ਹਨ ਉਸ ਨੇ ਕੰਪਿਊਟਰ ਕੋਰਸ ਫੈਸ਼ਨ ਡਿਜ਼ਾਇਨਿੰਗ ਸਭ ਕੁਛ ਕਰ ਰੱਖਿਆ ਹੈ ਜਿਹੜਾ ਕਿ ਉਸ ਨੂੰ ਕਦੇ ਭੁੱਖਾ ਨਹੀਂ ਮਰਨ ਦੇਵੇਗਾ ਕੰਪਿਊਟਰ ਦਾ ਅੱਜ ਕੱਲ੍ਹ ਯੁੱਗ ਹੈ ਤਾਂ ਉਹ ਕਦੇ ਸਾਰਿਆਂ ਨਾਲੋਂ ਪਿੱਛੇ ਨਹੀਂ ਰਹੇਗੀ ਮੈਂ ਆਪ ਦੋ ਦੋ ਡਿਗਰੀਆਂ ਕੀਤੀਆਂ ਹੋਈਆਂ ਹਨ ਅੱਜ ਕੱਲ੍ਹ ਇੱਕ ਡਿਗਰੀ ਨਾਲ ਵੀ ਗੁਜ਼ਾਰਾ ਨਹੀਂ ਚੱਲਦਾ ਅੱਜ ਕੱਲ੍ਹ ਲੋਕ ਦੋ ਦੋ ਤਿੰਨ ਤਿੰਨ ਡਿਗਰੀਆਂ ਲੈਂਦੇ ਹਨ ਅਤੇ ਪੜ੍ਹਾਈ ਪ੍ਰਤੀ ਸਭ ਨੂੰ ਜਾਗਰੂਕ ਹੋਣਾ ਹੀ ਚਾਹੀਦਾ ਹੈ ਧੰਨਵਾਦ